ਹੈਲੋ ਹਾਂਜੀ ਬੀ ਐਸ ਐਨ ਐਲ ਤੋਂ ਬੋਲ ਰਹੇ ਹੋ ਹਾਂਜੀ ਸਰ ਫ਼ਾਜ਼ਿਲਕਾ ਵਿਜੇ ਕਲੋਨੀ ਵਾਲੀ ਸਾਈਡ ਤੋਂ ਬੋਲ ਰਿਹਾ ਅਤੇ ਕੱਲ੍ਹ ਰਾਤ ਤੂਫ਼ਾਨ ਕਰਕੇ ਇੱਥੇ ਜਿਹੜਾ ਤਾਰਾਂ ਨੇ ਉਹ ਟੁੱਟ ਗਈਆਂ ਨੇ ਅਤੇ ਲੈਂਡਲਾਈਨ 'ਤੇ ਕਾਲ ਨਹੀਂ ਹੋ ਰਿਹਾ ਹਾਂਜੀ ਕੱਲ੍ਹ ਰਾਤ ਤੋਂ ਨਹੀਂ ਹੋ ਰਿਹਾ ਹਾਂਜੀ ਤਾਂ ਕੰਪਲੇਂਟ ਲਿਖਵਾਉਣੀ ਸੀ ਸਰ ਇਹਦੀ ਕਿ ਠੀਕ ਕਰਵਾਉਣਾ ਹੈ ਅਤੇ ਕਦੋਂ ਤੱਕ ਹੋ ਸਕਦਾ ਇਹ ਠੀਕ ਹਾਂਜੀ ਸਰ ਪੂਰੇ ਏਰੀਏ ਦੀ ਤਾਰਾਂ ਮਤਲਬ ਸਾਡੇ ਏਰੀਏ 'ਚ ਨਹੀਂ ਆ ਰਹੀ ਇਹ ਲੈਂਡਲਾਈਨ ਚੱਲ ਰਿਹਾ ਹਾਂਜੀ ਠੀਕ ਹੈ ਜੀ ਅਤੇ ਇਹ ਤੁਸੀਂ ਕੱਲ੍ਹ ਤੋਂ ਪਹਿਲਾਂ ਨਹੀਂ ਆ ਸਕਦੇ ਅੱਛਾ ਸਰ ਐਮਰਜਂਸੀ ਆ ਪੂਰੇ ਏਰੀਏ 'ਚ ਕਿੱਥੇ ਵੀ ਲੈਂਡਲਾਈਨ ਨਹੀਂ ਚੱਲ ਰਿਹਾ ਅਤੇ ਕਾਲ ਵੀ ਨਹੀਂ ਹੋ ਰਹੀ ਅਤੇ ਆ ਵੀ ਨਹੀਂ ਰਹੀ ਠੀਕ ਹੈ ਜੀ ਠੀਕ ਹੈ ਹਾਂਜੀ ਨਾਮ ਰਾਘਵ ਕੁੱਕੜ ਏਰੀਆ ਵਿਜੇ ਕਲੋਨੀ ਫ਼ਾਜ਼ਿਲਕਾ ਹਾਂਜੀ ਠੀਕ ਹੈ ਸਰ